ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਐਮਾਜੋਨ ਕਸਟਮਰ ਕੇਅਰ ਤੋਂ ਬੋਲ ਰਹੇ ਹੋ ਹਾਂਜੀ ਸਰ ਸਰ ਮੈਨੂੰ ਤੁਹਾਡੀ ਹੈਲਪ ਦੀ ਜ਼ਰੂਰਤ ਸੀ ਹਾਂਜੀ ਸਰ ਸਰ ਮੈਂ ਕੁਝ ਕੁ ਪ੍ਰੋਡਕਟ ਔਨਲਾਈਨ ਔਡਰ ਕੀਤੇ ਸੀ ਤੁਹਾਡੀ ਐਪ ਤੋਂ ਐਮਾਜੋਨ ਤੋਂ ਅਤੇ ਮੈਂ ਉਹ ਉਹਨਾਂ ਵਿੱਚੋਂ ਕੁਝ ਕੁ ਆਪਣੇ ਕਾਡ ਤੋਂ ਹਟਾਉਣਾ ਚਾਹੁੰਦੀ ਹਾਂ ਕੁਝ ਕੁ ਆਈਟਮਾਂ ਹਾਂਜੀ ਹਾਂਜੀ ਸਰ ਹਾਂਜੀ ਸਰ ਸਰ ਮੈਂ ਇੱਕ ਤਾਂ ਮੰਗਵਾਈ ਇੱਕ ਤਾਂ ਮੈਂ ਹਟਾਉਣਾ ਚਾਹੁੰਦੀ ਹਾਂ ਜੋ ਮੰਗਵਾਈ ਹੋਈ ਸੀ ਮੈਂ ਬੈੱਡਸ਼ੀਟਸ ਚਾਰ ਚਾਰਾਂ ਦਾ ਸੈੱਟ ਹੈ ਹਾਂਜੀ ਹਾਂਜੀ ਸਰ ਉਹੀ ਉਹੀ ਹਾਂਜੀ ਉਹ ਹਟਾ ਦਿਓ ਹਾਂਜੀ ਅਤੇ ਦੂਸਰੀ ਹੈਗੀ ਕਰਟਨਸ ਨੇ ਜੋ ਬਲੂ ਅਤੇ ਬਲੈਕ ਕਲਰ ਦੇ ਬਲੂ ਬਲੈਕ ਅਤੇ ਰੈਡ ਤਿੰਨ ਕਲਰ ਦੇ ਹੋਣਗੇ ਹਾਂਜੀ ਦੋ ਦੋ ਨੇ ਅਲੱਗ ਅਲੱਗ ਬਲੂ ਬਲੈਕ ਤਿੰਨ ਕਲਰ ਵਾਲੇ ਹਟਾ ਦਿਓ ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਅਤੇ ਥਰਡ ਆਈਟਮ ਨੇ ਜੋ ਉਹ ਹੈ ਲੰਚ ਬਾਕਸ ਅਤੇ ਨਾਲ ਬੋਟਲ ਹੋਵੇਗੀ ਹਾਂਜੀ ਹਾਂਜੀ ਸਰ ਹਾਂਜੀ ਉਹ ਵੀ ਹਟਾ ਦਿਓ ਹਾਂਜੀ ਇੱਕ ਹੋਵੇਗਾ ਸਰ ਹੈਂਡਬੈਗ ਹੈਂਡਬੈਗ ਹਾਂਜੀ ਹਾਂਜੀ ਹੈਂਡਬੈਗ ਬਲੈਕ ਕਲਰ ਦਾ ਹਾਂਜੀ ਉਹ ਵੀ ਹਟਾ ਦਿਓ ਠੀਕ ਹੈ ਸਰ ਇੱਕ ਹੋਰ ਮੈਂ ਹਟਾਉਣਾ ਚਾਹੁੰਦੀ ਹਾਂ ਮੈਂ ਤੁਹਾਨੂੰ ਦੇਖ ਕੇ ਦੱਸਦੀ ਹਾਂ ਉਹ ਹਾਂਜੀ ਸਰ ਬਸ ਮੈਨੂੰ ਇੱਕ ਮਿੰਟ ਦਿਓ ਮੈਂ ਦੇਖ ਕੇ ਤੁਹਾਨੂੰ ਦੱਸਦੀ ਹਾਂ ਹਾਂਜੀ ਹਾਂਜੀ ਮੈਂ ਦੇਖ ਲਾਂ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਕੀ ਹਟਾਉਨਾ ਮੈਂ ਠੀਕ ਹੈ ਠੀਕ ਹੈ ਸਰ ਹਾਂਜੀ ਸਰ ਉਹ ਹੈ ਟਰੇਅ ਸੈੱਟ ਅਤੇ ਬਾਊਲ ਸੈੱਟ ਹਾਂਜੀ ਇਕੱਠੇ ਨੇ ਉਹ ਦੋਨੋਂ ਹਾਂਜੀ ਹਾਂਜੀ ਉਹ ਵੀ ਹਟਾ ਦਿਓ ਹਾਂਜੀ ਸਰ ਠੀਕ ਹੈ ਠੀਕ ਹੈ ਓਕੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੀ ਹੈਲਪ ਕੀਤੀ ਮੈਂ ਤੁਹਾਡੀ ਬਹੁਤ ਬਹੁਤ ਧੰਨਵਾਦੀ ਹੋਵਾਂਗੀ ਠੀਕ ਹੈ ਸਰ ਠੀਕ ਹੈ ਠੀਕ ਹੈ ਜੀ ਧੰਨਵਾਦ